ਫਿਰ ਉਹਦੇ ਵਿੱਚ ਉਹਦੀ ਸਾਰੀ ਕੁਆਨਟੀਟੀ ਦੱਸੀ ਜਾਂਦੀ ਕਿੰਨੀ ਕੁਆਨਟੀਟੀ ਲੈਣੀ ਹੈ ਕੀ ਉਹਦੇ ਵਿੱਚ ਕੀ ਨਿਊਟ੍ਰੀਸ਼ੀਅਸ਼ ਹੁੰਦੇ ਨੇ ਕੀ ਪ੍ਰੋਟੀਨਸ ਹੈ ਸਾਰਾ ਕੁਛ ਉਹਦੇ ਸਾਰੇ ਸਟੈੱਪਸ ਦੱਸੇ ਜਾਂਦੇ ਹਨ ਜਿਵੇਂ ਆਪਾਂ ਦਹੀਂ ਭੱਲੇ ਲੈ ਲਉ ਉਹਦੇ ਵਿੱਚ ਜਿਵੇਂ ਦਾਲ ਹੈ ਹੈ ਨਾ ਛੋਲ ਅ ਮਹਾਂ ਦੀ ਦਾਲ ਹੈ ਉਸ ਨੂੰ ਇੱਕ ਦਿਨ ਪਹਿਲਾਂ ਭਿਓਂਇਆ ਜਾਂਦਾ ਫਿਰ ਉਹਨੂੰ ਇੱਕ ਦਿਨ ਰਾਤ ਪਹਿਲਾਂ ਭਿਓਂਇਆ ਜਾਂਦਾ ਫਿਰ ਅਗਲੇ ਦਿਨ ਉਸਨੂੰ ਮਿਕਸੀ ਦੇ ਵਿੱਚ ਵੀਟ ਕੀਤਾ ਜਾਂਦਾ ਹੈ ਅਤੇ ਬੀਟ ਕਰਕੇ ਫਿਰ ਉਹਦੇ ਉਹ ਭੱਲੇ ਬਣਾਏ ਜਾਂਦੇ ਹਨ ਉਹਨੂੰ ਫਰਾਈ ਕੀਤਾ ਜਾਂਦਾ ਇਹ ਸਾਰਾ ਕੁਛ ਤੁਹਾਨੂੰ ਇਹ ਕੋਰਸਿਸ ਦੇ ਵਿੱਚ ਸਿਖਾਇਆ ਜਾਂਦਾ ਹੈ ਜਿਸ ਦੇ ਥਰੂ ਉਸ ਵਿੱਚ ਭੱਲੇ ਤਿਆਰ ਹੋ ਜਾਂਦੇ ਹੈ ਫਿਰ ਉਹਨੂੰ ਡੈਕੋਰੇਟ ਕਿਵੇਂ ਕਰਨਾ ਹੈ

ਬਾਅਦ ਵਿੱਚ ਇਹਨਾਂ ਦੇ ਦੱਸਿਆ ਜਾਂਦਾ ਕਿੰਨੀ ਕੁਆਨਟੀਟੀ ਪੈਣੀ ਹੈ ਇਹਦੀ ਕੀ ਕਿਵੇਂ ਦੀ ਕੁਆਲਟੀ ਹੋਣੀ ਚਾਹੀਦੀ ਹੈ ਕੀ ਇਹਨਾਂ ਦੀ ਨਿਊਟ੍ਰੀਸ਼ੀਅਸ਼ ਵੈਲੀਊ ਹੈ ਕਿੰਨੀ ਇਹਨਾਂ 'ਚ ਕੈਲਰੀਜ਼ ਹੁੰਦੀਆਂ ਨੇ ਸਾਰੀਆਂ ਚੀਜ਼ਾਂ ਇਹਨਾਂ ਦੇ ਵਿੱਚ ਸਿਖਾਈਆਂ ਜਾਂਦੀਆਂ ਹਨ ਥੈਂਕ ਯੂ